ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਸਰ ਮੈਂ ਸਰ ਤੁਹਾਡੇ ਫ੍ਰੈਡ ਤੋਂ ਨੰਬਰ ਲਿੱਤਾ ਸੀ ਹਾਂਜੀ ਅਤੇ ਸਰ ਮੈਂ ਨਾ ਸਰ ਮੀਡੀਆ 'ਚ ਕੰਮ ਕਰਦਾ ਸਰ ਅਤੇ ਸਰ ਮੈਂ ਇੰਨਫੋਮੇਸ਼ਨ ਲੈਣੀ ਸੀ ਅਸੀਂ ਸਰਵੇ ਕੰਨਡਕਟ ਕਰਦੇ ਪਏ ਹਾਂ ਕੀ ਤੁਹਾਡੀ ਸਿਟੀ 'ਚ ਕਿਹੜੇ ਕਿਹੜੇ ਮਤਲਬ ਕੀ ਮੁੱਖ ਤਿਉਹਾਰ ਹੈ ਜਿਹੜੇ ਮਨਾਏ ਜਾਂਦੇ ਆ ਸ਼ਹਿਰ 'ਚ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ

ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਠੀਕ ਹੈ ਸਰ ਠੀਕ ਹੈ ਜੀ

ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਵਰਤਾਂ ਦਾ ਮਸ਼ਹੂਰ ਹੈ ਜੀ ਹਾਂਜੀ

ਅੱਛਾ ਨਵਾਂਸ਼ਹਿਰ 'ਚ ਦੁਸਹਿਰਾ ਮਤਲਬ ਕਿ ਵਧੀਆ ਮਨਾਇਆ ਜਾਂਦਾ ਹਾਂਜੀ ਅੱਛਾ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਸਰ ਮੈਂ ਫਿਰ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਨੌ ਡਾਊਟ ਸਰ ਮੈਂ ਸਰਵੇ ਸਰ ਹਾਂਜੀ ਹਾਂਜੀ ਹਾਂਜੀ ਸਰ ਸਹੀ ਗੱਲ ਹੈ ਹਾਂਜੀ ਆਰਟੀਕਲ ਲਿਖਾਂਗੇ ਇਸ ਬਾਰੇ ਚਲੋ ਠੀਕ ਹੈ ਠੀਕ ਹੈ ਸਰ ਓਕੇ